ਪੰਜਾਬੀ ਪਰਿਵਾਰ ਵਿੱਚ ਬੱਚੇ ਦੇ ਜਨਮ ਸਮੇਂ ਬਹੁਤ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਅਤੇ ਹਰ ਇੱਕ ਰਿਸ਼ਤੇਦਾਰ ਕਾਫ਼ੀ ਦਿਨਾਂ ਤੱਕ ਆਪਣਾ ਵਧਾਈਆਂ ਦਿੰਦੇ ਹਨ ਮਠਿਆਈਆਂ ਲੈ ਕੇ ਆਉਂਦੇ ਹਨ ਅਤੇ ਹਰ ਇੱਕ ਪਰਿਵਾਰਕ ਮੈਂਬਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਬੱਚਾ ਜਨਮ ਲੈਣ ਸਮੇਂ ਬੱਚੇ ਨੂੰ ਮੁੰਡੇ ਵੇਲੇ ਆਪਣਾ ਨਿੰਮ ਵੀ ਬੰਨਿਆ ਜਾਂਦਾ ਹੈ ਅਤੇ ਕਾਫ਼ੀ ਲੇਡੀਜ਼ ਇਕੱਠੀਆਂ ਹੁੰਦੀਆਂ ਹਨ ਉਹਨਾਂ ਨੂੰ ਮਿਠਾਈਆਂ ਵੰਡੀਆਂ ਜਾਂਦੀਆਂ ਅਤੇ ਪੈਸੇ ਦਿੱਤੇ ਜਾਂਦੇ ਹਨ ਅਤੇ ਇੱਦਾਂ ਬੱਚੇ ਹੋਣ 'ਤੇ ਅੱਜ ਕੱਲ੍ਹ ਪੰਜਾਬੀ ਪਰਿਵਾਰਾਂ ਵਿੱਚ ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਦੇ ਉਹਦੇ ਨਾਲ ਗਿਣਦੇ ਆ ਗੁ ਕੁੜੀਆਂ ਦੇ ਜੰਮਣ 'ਤੇ ਲੋਹੜੀ ਲੋ ਲੋਹੜੀਆਂ ਵੰਡਦੇ ਨੇ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਨਿੰਮ ਵਗੈਰਾ ਵੀ ਬੰਨੇ ਜਾਂਦੇ ਆ ਅਤੇ ਇੱਦਾਂ ਪੰਜਾਬੀ ਪਰਿਵਾਰ ਦੇ ਵਿੱਚ ਹਰ ਇੱਕ ਬੱਚੇ ਦੇ ਜਨਮ ਨੂੰ ਇੱਕ ਤਿਉਹਾਰ ਵਾਂਗ ਮਨਾਇਆ ਜਾਂਦਾ ਅਤੇ ਖੁਸ਼ੀ ਦਾ ਮਾਹੌਲ ਹੁੰਦਾ ਪੂਰੇ ਪਰਿਵਾਰ ਵਿੱਚ ਅਤੇ ਬੱਚਾ ਜਨਮ ਸਮੇਂ ਬੱਚੇ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ ਪੰਜਾਬੀ ਪਰਿਵਾਰ ਦੀ ਗੁੜ੍ਹਤੀ ਤਾਂ ਅੰਮ੍ਰਿਤ ਵਾਟੇ ਤੋਂ ਵੀ ਜ਼ਿਆਦਾ ਮਸ਼ਹੂਰ ਮੰਨੀ ਜਾਂਦੀ ਹੈ ਇਸ ਕਰਕੇ ਬੱਚੇ ਦਾ ਸੁਭਾਅ ਹੈ ਨਾ ਵੀ ਥੋੜ੍ਹਾ ਸ਼ਾਂਤ ਹੁੰਦਾ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਬੰਦਾ ਬੱਚੇ ਨੂੰ ਗੁੜ੍ਹਤੀ ਦਿੰਦਾ ਬੱਚੇ ਦਾ ਸੁਭਾਅ ਉਸ ਦੇ ਅਕੋਰਡਿੰਗ ਹੀ ਅੱਗੇ ਜਾ ਕੇ ਬਣਦਾ ਹੈਗਾ ਅਤੇ ਬੱਚੇ ਦੇ ਜਨਮ ਅਨੁਸਾਰ ਪਰਿਵਾਰ ਵਿੱਚ ਕਾਫ਼ੀ ਖੁਸ਼ੀ ਦਾ ਮਾਹੌਲ ਮੰਨਿਆ ਜਾਂਦਾ ਹੈ